ਸਤਿ ਸ਼੍ਰੀ ਅਕਾਲ ਸਰ ਮੈਮ ਅਸੀਂ ਨਾ ਤੁਹਾਡੇ ਸ਼ੌਪ ਮੈਮ ਮੈਂ ਆਨਲਾਈਨ ਫੋਨ ਦੇਖੇ ਸੀ ਮੋਬਾਇਲ 'ਤੇ ਵੀਵੋ ਤੇ ਓਪੋ ਤੇ ਹੋਰ ਵੀ ਕੰਪਨੀ ਦਾ ਹੈਗੇ ਸੀ ਮੋਬਾਇਲ ਤੇ ਉਥੇ ਬਹੁਤ ਘੱਟ ਰੇਟ ਦੱਸਿਆ ਹੋਇਆ ਸੀ ਤੇ ਰੈੱਡਮੀ ਵਗੈਰਾ ਦਾ ਵੀ ਬਹੁਤ ਵਧੀਆ ਹੈਗਾ ਸੀ ਉਹਨਾਂ ਕੋਲ ਸਿਸਟਮ ਵਧੀਆ ਮਿਲਦੀ ਹੈ ਤੇ ਮੈਮ ਆਪਣੀ ਸ਼ੋਪ ਤੋਂ ਮਿਲਜੇਗਾ ਸੇਮ ਹੀ ਚਾਹੀਦਾ ਜੀ ਹਾਂਜੀ ਹਾਂਜੀ ਡਿਸਕਾਊਂਟ ਵਗੈਰਾ ਵੀ ਦਿਓਗੇ ਨਾ ਠੀਕ ਹੈ ਜੀ ਮੈਂ ਹਾਂਜੀ ਤੁਸੀਂ ਨਾ ਮੈਨੂੰ ਵੀਵੋ ਦਾ ਦਿਖਾ ਦਿਓ ਵੀਵੋ ਮੋਡਲ ਦੇ ਮਾਡਲ ਤੁਸੀਂ ਨਾਈਨ ਏ ਵਾਲਾ ਦਿਖਾ ਦਿਓ ਹਾਂਜੀ ਹਾਂਜੀ ਚਾਰਜਰ ਵਗੈਰਾ ਨਾਲ ਹੀ ਮਿਲੂਗਾ ਹਾਂਜੀ ਠੀਕ ਐ ਜੀ ਇਹਦੇ ਚ ਕਿੰਨੇ ਐਮਬੀ ਆਪਾਂ ਨੂੰ ਡਾਟਾ ਮਿਲੇਗਾ ਠੀਕ ਹ ਜੀ ਤੇ ਠੀਕ ਆ ਜੀ ਮੈਂ ਨਾ ਆਨਲਾਈਨ ਦੇਖੇ ਸੀ ਮੈਂ ਕਿਹਾ ਸ਼ਾਇਦ ਨਾ ਹੀ ਮਿਲੇ ਇਥੋਂ ਸ਼ੋਪ ਤੋਂ ਬਾਕੀ ਫਿਰ ਮੈਂ ਤੁਹਾਡੇ ਹਾਂਜੀ ਸਰਚ ਕਰਕੇ ਦੇਖਿਆ ਸੀ ਤੇ ਤੁਹਾਡੇ ਸ਼ੌਪ ਦਾ ਆਇਆ ਸੀ ਠੀਕ ਹ ਜੀ ਤੇ ਹਾਂਜੀ ਸਾਨੂੰ ਹਾਂਜੀ ਬਲਿਊ ਕਲਰ ਵਿੱਚ ਹਾਂਜੀ ਬਲਿਊ ਕਲਰ ਵਿੱਚ ਮਿਲ ਜਾਏਗਾ ਫੋਨ ਤੁਸੀਂ ਆਪਣੇ ਠੀਕ ਹੈ ਜੀ ਤੇ ਥੈਂਕਯੂ ਮੈਮ